ਆਪ ਜੀ ਦੁਆਰਾ ਪੁੱਛੇ ਗਏ ਪ੍ਰਸ਼ਨ ਮੁਤਾਬਿਕ ਪੰਜ ਗੁਆਂਢੀਆਂ ਦੇ ਨਾਮ ਦੱਸ ਰਿਹਾ ਹਾਂ ਵੈਸੇ ਤਾਂ ਸਾਡੇ ਅਨੁਪਮ ਬਹੁਤ ਸਾਰੇ ਹਨ ਪਰ ਮੈਂ ਉਹਨਾਂ ਦਾ ਨਾਂ ਲੈਣਾ ਚਾਹੁੰਦਾ ਹਾਂ ਜੋ ਮੇਰੇ ਖਾਸ ਫਰੈਂਡ ਹਨ ਮੇਰਾ ਸਭ ਤੋਂ ਪਹਿਲਾ ਗੁਆਂਢੀ ਹੈ ਗੁਰਪ੍ਰੀਤ ਸਿੰਘ ਗਿੱਲ ਦੂਸਰੇ ਨੰਬਰ 'ਤੇ ਮੈਂ ਆਪਣੇ ਗੁਆਂਢੀ ਰੁਪਿੰਦਰ ਸ਼ਰਮਾ ਦਾ ਨਾਂ ਲੈਣਾ ਚਾਹੁੰਦਾ ਹਾਂ ਤੀਸਰੇ ਨੰਬਰ 'ਤੇ ਰੂਪੇਸ਼ ਗੋਇਲ ਅਤੇ ਤੀਸਰੇ ਨੰਬਰ 'ਤੇ ਅਨੀਰੁੱਧ ਗੋਇਲ ਅਤੇ ਪੰਜਵੇਂ ਨੰਬਰ 'ਤੇ ਮਨਪ੍ਰੀਤ ਸਿੰਘ ਗਿੱਲ ਦਾ ਨਾਂ ਲੈਣਾ ਚਾਹੁੰਦਾ ਹਾਂ